ਹੈਲੋ

ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਅਤੇ ਅੱਜ ਕੱਲ੍ਹ ਇੱਧਰ ਵੀ ਕਮਾਈ ਰੋਜ਼ਗਾਰ ਘੱਟ ਰਹੇ ਆ ਤਾਂ ਕਰਕੇ ਲੋਕ ਬਾਹਰ ਜਾ ਰਹੇ ਆ ਅੱਜ ਕੱਲ੍ਹ ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈ ਹਾਂਜੀ ਹਾਂਜੀ ਇਹ ਤਾਂ ਆ ਬਟ ਅੱਜ ਕੱਲ੍ਹ ਇੱਧਰ ਰੋਜ਼ਗਾਰ ਬੱਚਿਆਂ ਨੂੰ ਮਿਲ ਨਹੀਂ ਰਿਹਾ ਤਾਂ ਕਰਕੇ ਬਹੁਤ ਜ਼ਿਆਦਾ ਅੱਜ ਕੱਲ੍ਹ ਬਾਹਰ ਜਾ ਰਹੇ ਆ ਬੱਚੇ ਇੱਧਰ ਕੋਈ ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਫਿਰ ਕੋਈ ਕਮਾਈ ਦਾ ਸਾਧਨ ਨਹੀਂ ਫਿਰ ਤਾਂ ਕਰਕੇ ਫਿਰ ਮਾਂ ਪਿਓ ਬਾਹਰ ਭੇਜ ਰਹੇ ਆ ਬੱਚਿਆਂ ਨੂੰ ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈ ਕਰ ਤਾਂ ਸਕਦੇ ਹਾਂ ਬਟ ਫਿਰ ਅੱਜ ਕੱਲ੍ਹ ਬੱਚੇ ਫਿਰ ਜ਼ਿਆਦਾਤਰ ਬਾਹਰ ਲਈ ਉਹ ਕਰ ਰਹੇ ਆ ਜਾ ਰਹੇ ਆ ਹਾਂਜੀ ਹਾਂਜੀ ਹਾਂਜੀ ਜੇਕਰ ਕਮਾਈ ਦਾ ਹਾਂ ਕਮਾਈ ਦਾ ਸਾਧਨ ਹੋਊਗਾ ਤਾਂ ਬੱਚੇ ਇੱਧਰ ਵੀ ਰਹਿ ਸਕਦੇ ਆ ਬਟ ਉਂਝ ਜਦੋਂ ਕਮਾਈ ਦਾ ਸਾਧਨ ਨਹੀਂ ਤਾਂ ਕਰਕੇ ਬੱਚੇ ਜਾ ਰਹੇ ਆ ਅੱਜ ਕੱਲ੍ਹ ਬਾਹਰ ਹਾਂਜੀ ਹਾਂਜੀ ਠੀਕ ਠੀਕ ਹੈ ਠੀਕ